ਖੇਡਾਂ ਅੱਜ ਕੱਲ ਪੂਰੇ ਸਮਾਜ ਵਿੱਚ ਪੂਰੇ ਦੇਸ਼ ਦੇ ਲਈ ਬਹੁਤ ਹੀ ਜ਼ਰੂਰੀ ਹੋ ਗਈਆਂ ਹਨ ਇਹਨਾਂ ਤੋਂ ਬਿਨਾਂ ਆਦਮੀ ਜਿਹੜੇ ਹੈ ਲੋਕ ਹੈ ਉਹ ਨਸ਼ੀਲੀਆਂ ਵਸਤੂਆਂ ਦੇ ਆਦੀ ਬਣ ਗਏ ਹਨ ਅਤੇ ਅਲੱਗ ਅਲੱਗ ਬਿਮਾਰੀਆਂ ਨਾਲ ਘਿਰ ਗਏ ਹਨ ਕਿੰਨਾ ਚੰਗਾ ਹੁੰਦਾ ਕਿ ਖੇਡਾਂ ਦੇ ਵੱਲ ਸਰਕਾਰ ਅਤੇ ਲੋਕ ਆਪਸੀ ਸਹਿਯੋਗ ਦੇ ਨਾਲ ਜ਼ਿਆਦਾ ਜ਼ੋਰ ਦੇਣ ਤਾਂ ਕਿ ਲੋਕ ਆਪਣਾ ਸੁੱਖਮਈ ਜੀਵਨ ਬਤੀਤ ਕਰ ਸਕਣ ਇਸ ਦੇ ਨਾਲ ਆਦਮੀ ਦੇ ਵਿੱਚ ਸਹਿਣਸ਼ੀਲਤਾ ਲੀਡਰਸ਼ਿਪ ਅਤੇ ਹੋਰ ਕਈ ਇਹੋ ਜਿਹੇ ਗੁਣ ਆਉਂਦੇ ਹਨ ਤਾਂ ਕਿ ਉਹ ਅੱਗੇ ਜਾ ਕੇ ਇਹਨਾਂ ਗੁਣਾਂ ਦੇ ਸਦਕਾ ਚੰਗੇ ਆਗੂ ਅਤੇ ਚੰਗੇ ਨੇਤਾ ਬਣ ਸਕਦੇ ਹਨ